ਅਸੀਂ ਘਰ ਵਿੱਚ ਚਾਹ ਵੀ ਬਣਾਉਂਦੇ ਹਾਂ ਜਿਹਦੇ ਵਿੱਚ ਦੁੱਧ ਖੰਡ ਪੱਤੀ ਸਭ ਕੁਛ ਇਲਾਚੀ ਲੋਂਗ ਜੋ ਵੀ ਅਸੀਂ ਆਪਣੀ ਮਰਜ਼ੀ ਦੇ ਅਨੁਸਾਰ ਵਰਤੋਂ ਕਰ ਸਕਦੇ ਹਾਂ ਅਸੀਂ ਨਿੰਬੂ ਪਾਣੀ ਵੀ ਘਰ ਵਿੱਚ ਬਣਾਉਂਦੇ ਹਾਂ ਅਸੀਂ ਸ਼ੇਕ ਵੀ ਬਰੋ ਸ ਬਣਾ ਸਕਦੇ ਬਣਾ ਸਕਦੇ ਹਾਂ ਜਿਹਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੇ ਫਰੂਟਸ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਕੇਲ ਕੇਲਿਆਂ ਦੀ ਕਰ ਲੈਂਦੇ ਹਾਂ ਅਸੀਂ ਹੈ ਨਾ ਸਟੋਬਰੀ ਦੀ ਕਰ ਲੈਂਦੇ ਹਾਂ ਗਾਜਰਾਂ ਦੀ ਕਰ ਲੈਂਦੇ ਹਾਂ ਇਹ ਤੋਂ ਇਲਾਵਾ ਅਸੀਂ ਘਰ ਵਿੱਚ ਜੂਸ ਵੀ ਬਣਾਉਂਦੇ ਹਾਂ ਜਿਵੇਂ ਸਰਦੀ ਦੇ ਮੌਸਮ ਵਿੱਚ ਸੰਤਰੇ ਗਾਜਰਾਂ ਹੈ ਨਾ ਅਨਾਰ ਕਿਸੇ ਵੀ ਪ੍ਰਕਾਰ ਦੇ ਫਰੂਟ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਜੂਸ ਵਿੱਚ ਇਹ ਤੋਂ ਇਲਾਵਾ ਅਸੀਂ ਔਰ ਵੀ ਕਈ ਪ੍ਰਕਾਰ ਦੇ ਪੀਣ ਵਾਲੇ ਸ਼ੇਕ ਬਣਾ ਸਕਦੇ ਹਾਂ ਨਿੰਬੂ ਪਾਣੀ ਬਣਾਉਂਦੇ ਹਾਂ ਜਿਹਦੇ ਵਿੱਚ ਨਿੰਬੂ ਦੀ ਵਰਤੋਂ ਹੁੰਦੀ ਹੈ ਮੌਸਟਲੀ ਸ ਗਰਮੀਆਂ ਦੇ ਮੌਸਮ ਵਿੱਚ ਅਸੀਂ ਕਤੀਰਾ ਗੂੰਦ ਇੱਕ ਵਰਤੀ ਜਾਂਦੀ ਹੈ ਘਰਾਂ ਵਿੱਚ ਜੇ ਤਸੀਰ ਠੰਡੀ ਹੁੰਦੀ ਆ ਉਹਦੀ ਵਰਤੋਂ ਕਰ ਸਕਦੇ ਹਾਂ ਅਸੀਂ ਦੁੱਧ ਵਿੱਚ ਮਿਕਸ ਕਰਕੇ ਗੁੜ ਵਾਲਾ ਪਾਣੀ ਵੀ ਕੁਛ ਕੁਛ ਘਰਾਂ ਵਿੱਚ ਬਣਾਇਆ ਜਾਂਦਾ ਹੈ ਹਾਂ ਚੀਨੀ ਦੀ ਵਰਤੋਂ ਵੀ ਕਰ ਸਕਦੇ ਹਾਂ ਅਸੀਂ ਇਹਦੇ ਵਿੱਚ ਇਹ ਤੋਂ ਇਲਾਵਾ ਅਸੀਂ ਔਰ ਵੀ ਕਈ ਪ੍ਰਕਾਰ ਦੀਆਂ ਪੀਣ ਵਾਲੀਆਂ ਚੀਜ਼ਾਂ ਘਰ ਵਿੱਚ ਬਣਾ ਸਕਦੇ ਹਾਂ